ਅੱਜ ਕੱਲ੍ਹ ਬਹੁਤ ਸਾਰੇ ਨੌਜਵਾਨ ਬੇਰੁਜ਼ਗਾਰ ਫਿਰ ਰਹੇ ਨੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਉਹ ਵਿਹਲੇ ਫਿਰਦੇ ਨੇ ਵਿਹਲੇ ਹੋਣ ਦੇ ਕਾਰਨ ਉਹ ਨਸ਼ਿਆਂ ਵੱਲ ਲੱਗ ਰਹੇ ਨੇ ਅਤੇ ਸਰਕਾਰ ਇਹਨਾਂ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ ਹੈ ਜਿਵੇਂ ਕਿ ਹੁਣ ਸਰ ਜਿਵੇਂ ਕਿ ਹੁਣ ਸਰਕਾਰੀ ਸਕੂਲਾਂ ਦੀਆਂ ਟੀਚਰਾਂ ਦੀਆਂ ਪੋਸਟਾਂ ਖਾਲੀਆਂ ਪਈਆਂ ਹਨ ਉਹ ਪੋਸਟਾਂ ਸਰਕਾਰ ਨੂੰ ਕੱਢਣੀਆਂ ਚਾਹੀਦੀਆਂ ਹਨ ਅਤੇ ਉਹਨਾਂ 'ਤੇ ਟੀਚਰਾਂ ਨੂੰ ਰੱਖਣਾ ਚਾਹੀਦਾ ਹੈ ਜਾਂ ਕਿ ਤਾਂ ਕਿ ਜੋ ਨੌਜਵਾਨ ਵਿਹਲੇ ਫਿਰ ਰਹੇ ਨੇ ਉਹਨਾਂ ਨੂੰ ਕੋਈ ਰੁਜ਼ਗਾਰ ਮਿਲੇ ਅਤੇ ਸਰਕਾਰ ਨੂੰ ਇਹਨਾਂ ਵੱਲ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਸਰਕਾਰ ਨੂੰ ਫੈਕਟਰੀਆਂ ਖੋਲ੍ਹਣੀਆਂ ਚਾਹੀਦੀਆਂ ਹਨ ਜਿਨ੍ਹਾਂ ਨਾਲ਼ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ ਉਹ ਉਸ ਫੈਕਟਰੀਆਂ 'ਚ ਕੰਮ ਕਰਨ ਸਕਣ ਅਤੇ ਜੋ ਪੋ ਜੋ ਵੀ ਪੋਸਟਾਂ ਜਾਂ ਸਰਕਾਰੀ ਪੋਸਟਾਂ ਪ੍ਰਾਈਵੇਟ ਪੋਸਟਾਂ ਖਾਲੀ ਪਈਆਂ ਹਨ ਉਹਨਾਂ 'ਤੇ ਸਰਕਾ ਸਰਕਾਰ ਨੌਜਵਾਨਾਂ ਨੂੰ ਨੌਕਰੀ ਦੇਵੇ ਅਤੇ ਪੰਜਾਬ ਪੁਲਿਸ ਦੀਆਂ ਜਿਹੜੀਆਂ ਪੋਸਟਾਂ ਨੇ ਉਹ ਵੀ ਵੱਧ ਤੋਂ ਵੱਧ ਕੱਢੀਆਂ ਜਾਣ ਜਿਸ ਨਾਲ਼ ਨੌਜਵਾਨਾਂ ਨੂੰ ਵੀ ਰੁਜ਼ਗਾਰ ਮਿਲੇ